ਹੈਲੋ ਹੈਲੋ ਤੁਸੀਂ ਕੇਕ ਵਾਲੀ ਸ਼ੋਪ ਤੋਂ ਬੋਲਦੇ ਐ ਅਤੇ ਤੁਹਾਡੇ ਕੋਲ ਕੇਕ ਬਣਾਉਂਦੇ ਹੋ ਤੁਸੀਂ ਵੀ ਆ ਚੋਕਲੇਟ ਵਾਲਾ ਸਟੋਵਰੀ ਵਾਲਾ ਅਤੇ ਫਰੂਟਸ ਵਾਲਾ ਅਤੇ ਹੋਰ ਕਿੰਨੇ ਕੁ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਬਣਾ ਲੈਂਦੇ ਐ ਵੀ ਕਿਵੇਂ ਕੇਕ ਅੱਛਾ ਕੇਕ ਵਧੀਆ ਹੋਊਗਾ ਅਤੇ ਕੀ ਰੇਟ ਹੈ ਕਿਲੋ ਦੇ ਕੇਕ ਦਾ ਅੱਛਾ ਕਿਲੋ ਦਾ ਅੱਛਾ ਅੱਛਾ ਅਤੇ ਹੋਰ ਵੀ ਹੋਰ ਵਧੀਆ ਹੋਰ ਕੀ ਕੁਛ ਬਣਾਉਂਦੇ ਹੋ ਤੁਸੀਂ ਅੱਛਾ ਅੱਛਾ ਅੱਛਾ

ਅੱਛਾ ਅਤੇ ਵੀ ਕੇਕ 'ਤੇ ਵੀ ਵਧੀਆ ਡੈਕੋਰੇਸ਼ਨ ਹੋਣੀ ਚਾਹੀਦੀ ਆ ਅਤੇ ਮੇਰੇ ਮੁੰਡੇ ਦਾ ਜਨਮ ਦਿਨ ਹੈ ਅਤੇ ਕਿਹੜਾ ਕੇਕ ਵਧੀਆ ਰਹਿੰਦਾ ਵੀ ਬਣਾਈਏ ਅਤੇ ਪੰਜ ਕਿਲੋ ਦਾ ਕਿੰਨੇ ਦਾ ਫਿਰ ਬਣੇਗਾ ਕਿਆ ਬਾਤ ਅੱਛਾ ਕੋਈ ਲੈਸ ਵੀ ਕਰੋਗੇ ਹੀ ਅੱਛਾ ਅੱਛਾ ਤਾਜ਼ਾ ਹੀ ਬਣਾ ਕੇ ਦਿਓ ਜੀ ਅੱਛਾ ਅਤੇ ਕ੍ਰੀਮ ਵਧੀਆ ਹੋਣੀ ਚਾਹੀਦੀ ਹੈ ਅੱਛਾ ਐ ਨਾ ਫਿਰ ਬੱਚਿਆਂ ਨੇ ਖਾਣਾ ਹੁੰਦਾ ਅਤੇ ਕੱਲ੍ਹ ਨੂੰ ਓਰਡਰ ਸਾਡਾ ਵੀ ਮਿਲ ਜਾਊਗਾ ਅੱਛਾ ਅਤੇ ਫਿਰ ਸਾਨੂੰ ਚੋਕਲੇਟ ਵਾਲਾ ਹੀ ਬਣਾ ਦਿਓ ਜੀ ਦੋ ਕਿਲੋ ਦਾ ਅਤੇ ਵਧੀਆ ਹੋਣਾ ਚਾਹੀਦਾ ਕੇਕ ਮਾੜਾ ਨਾ ਹੋਵੇ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਐ ਫਿਰ ਕੱਲ੍ਹ ਕੱਲ੍ਹ ਆਵਾਂਗੇ ਫਿਰ ਤਿਆਰ ਹੋਣਾ ਚਾਹੀਦਾ ਚੋਕਲੇਟ ਵਾਲਾ ਕੇਕ ਦੋ ਕਿਲੋ ਦਾ ਉਹ ਅਸੀਂ ਦੱਸ ਦਿਆਂਗੇ